ਤੀਹ ਅਗਸਤ ਦੋ ਹਜ਼ਾਰ ਪੰਜ ਦੋ ਦਸੰਬਰ ਉੱਨੀ ਸੌ ਇਕਾਸੀ ਪੱਚੀ ਜਨਵਰੀ ਵੀਹ ਸੌ ਸਤਾਰਾਂ ਨੌ ਜੂਨ ਵੀਹ ਸੌ ਤੇਈ ਸਤਾਰਾਂ ਮਈ ਵੀਹ ਸੌ ਪੰਦਰਾਂ